ਵੈਸੇ ਤਾਂ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ ਕੋਈ ਵੀ ਇਨਸਾਨ ਕਿਸੇ ਵੀ ਕੰਮ 'ਚ ਨਿਪੁੰਨ ਨਹੀਂ ਹੈ ਹਰ ਇਨਸਾਨ ਕਦੇ ਨਾ ਕਦੇ ਤਾਂ ਗ਼ਲਤੀ ਕਰਦਾ ਹੈ ਜੇ ਅਸੀਂ ਗ਼ਲਤੀ ਨਹੀਂ ਕਰਾਂਗੇ ਤਾਂ ਅਸੀਂ ਸਿਖਾਂਗੇ ਕਿਵੇਂ ਇਸੇ ਤਰ੍ਹਾਂ ਮੇਰੇ ਤੋਂ ਵੀ ਗ਼ਲਤੀ ਹੋਈ ਸੀ ਜਦੋਂ ਮੈਂ ਆਪਣੀ ਪੜ੍ਹਾਈ ਕਰ ਰਹੀ ਸੀਗੀ ਉਦੋਂ ਮੇਰੇ ਦੋ ਪੇਪਰ ਇਕੱਠੇ ਆ ਗਏ ਸੀ ਕੁਝ ਪੜ੍ਹਾਈ 'ਚ ਓਸ ਉਹਨਾਂ ਦੇ ਜਦੋਂ ਮੈਂ ਸਬਜੈਕਟ ਲਏ ਸੀਗੇ ਉਹਨਾਂ 'ਚ ਹੀ ਕੋਈ ਕੋਨਟਰਾਡਿਕਸ਼ਨ ਆ ਗਈ ਸੀਗੀ ਫਿਰ ਯੂਨੀਵਰਸਿਟੀ ਤੋਂ ਕੋਲ ਆਈ ਕਿ ਤੁਹਾਡੇ ਦੋ ਪੇਪਰ ਇਕੱਠੇ ਨੇ ਅਤੇ ਮੈਂ ਤਾਂ ਘਰੇ ਦੱਸ ਨਹੀਂ ਸਕਦੀ ਸੀਗੀ ਕਿਉਂਕਿ ਇੱਕ ਮੇਰਾ ਪਿਛਲੇ ਸਮੈਸਟਰ ਦਾ ਪੇਪਰ ਇੱਕ ਇਸ ਸਾਲ ਦਾ ਪੇਪਰ ਦੋਨੇ ਇਕੱਠੇ ਹੋ ਗਏ ਸਵੇਰ ਟਾਈਮ ਤਾਂ ਫਿਰ ਮੈਂ ਘਰੇ ਆ ਕੇ ਝੂਠ ਬੋਲਿਆ ਕਿ ਮੈਂ ਦੋਨੋਂ ਪੇਪਰ ਦੇ ਆਈ ਹਾਂ ਅਤੇ ਮੇਰੇ ਦੋਨਾਂ ਪੇਪਰਾਂ ਦਾ ਰਿਜਲਟ ਆਜੇਗਾ ਪਰ ਨਹੀਂ ਮੈਂ ਉਸ ਟਾਈਮ ਇੱਕ ਪੇਪਰ ਤਾਂ ਦਿੱਤਾ ਹੀ ਨਹੀਂ ਸੀ ਸਭ ਤੋਂ ਵੱਡੀ ਗ਼ਲਤੀ ਸੀਗੀ ਮੇਰੀ ਅਤੇ ਫਿਰ ਉਸ ਤੋਂ ਬਾਅਦ ਉਹਦੀ ਫ਼ੀਸ ਪੰਦਰ੍ਹਾਂ ਸੌ ਪੱਚੀ ਰੁਪਏ ਭਰਨੇ ਸੌਖੀ ਗੱਲ ਸੀ ਕਿਉਂਕਿ ਸਟੂਡੈਂਟ ਕੋਲ ਤਾਂ ਪੰਦਰ੍ਹਾਂ ਸੌ ਪੱਚੀ ਰੁਪਈਏ ਕਦੀ ਪੋਕਿਟ ਮਨੀ ਜੁੜਦੀ ਨਹੀਂ ਜੇ ਜੁੜਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਬੇਫਾਲਤੂ ਖ਼ਰਚਿਆ ਵਿੱਛ ਖ਼ਰਚ ਕਰ ਦਿੰਦੇ ਹਾਂ ਅਤੇ ਫਿਰ ਕਿੱਦਾਂ ਕਰਕੇ ਮੈਂ ਪੰਦਰ੍ਹਾਂ ਸੌ ਪੱਚੀ ਰੁਪਏ ਜੋੜੇ ਕਿ ਹਾਂ ਮੈਂ ਉਸ ਪੇਪਰ ਦੀ ਫ਼ੀਸ ਭਰਨੀ ਕਿਉਂਕਿ ਅਗਰ ਉਹ ਪੇਪਰ ਨਾ ਪਾਉਂਦੀ ਤਾਂ ਮੇਰੀ ਡਿਗਰੀ ਨਾ ਕੰਪਲੀਟ ਹੁੰਦੀ ਅਤੇ ਫਿਰ ਮੈਂ ਘਰਦਿਆਂ ਤੋਂ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਪੈਸਿਆ ਨੂੰ ਥੋੜ੍ਹੇ ਥੋੜ੍ਹੇ ਕਰਕੇ ਜਮ੍ਹਾ ਕਰਦੀ ਰਹੀ ਫਿਰ ਇ ਉਹ ਪੇਪਰ ਤਾਂ ਮੈਂ ਪਾ ਦਿੱਤਾ ਪੈਸੇ ਜਮ੍ਹਾ ਕਰਵਾ ਆਈ ਪੇਪਰ ਪਾ ਦਿੱਤਾ ਪਰ ਫਿਰ ਵੀ ਉਹ ਮੇਰੀ ਗ਼ਲਤੀ ਮੇਰੇ ਘਰ ਪਤਾ ਲੱਗ ਗਈ ਸੀਗੀ ਕਿਉਂਕਿ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਚੋਰ ਕੀ ਚੋਰ ਦੀ ਦਾੜ੍ਹੀ 'ਚ ਤਿਨਕਾ ਹੁੰਦਾ ਕਿਤੇ ਨਾ ਕਿਤੇ ਬੰਦਾ ਫੜ੍ਹ ਹੋ ਜਾਂਦਾ ਹੈ ਜਦੋਂ ਤੁਸੀਂ ਗ਼ਲਤੀ ਕਰਦੇ ਹੋ ਇਸ ਤਰ੍ਹਾਂ ਫਿਰ ਮੈਂ ਉਹ ਗ਼ਲਤੀ ਕੀਤੀ ਸੀਗੀ ਉਹਨੂੰ ਸੰਭਾਲ ਵੀ ਲਿਆ ਸੀਗਾ ਪਰ ਸੰਭਾਲਣ ਤੋਂ ਬਾਅਦ ਫਿਰ ਵੀ ਪਤਾ ਲੱਗ ਗਿਆ ਸੀ